ਭੰਗੜਾ ਸਾਡੇ ਪੰਜਾਬ ਦਾ ਇੱਕ ਜਿਹੜਾ ਡਾਂਸ ਇੱਕ ਫੋਮ ਹੈ ਫੋਕ ਫੋਕ ਡਾਂਸ ਕਿਹਾ ਜਾਂਦਾ ਸਾਡੇ ਭੰਗੜਾ ਭੰਗੜੇ ਵਿੱਚ ਜਿਹੜੇ ਪੰਜਾਬੀ ਹੈ ਉਹ ਜਿੱਦਾਂ ਖੁੱਲ੍ਹ ਕੇ ਜਿਹੜਾ ਜਿਹੜਾ ਸਾਡੇ ਫੋਮ ਹੈ ਜਿਹੜੀ ਭੰਗੜੇ ਦੌਰਾਨ ਹੱਥਾਂ ਬਾਹਾਂ ਪੈਰਾਂ ਨੂੰ ਖੋਲ੍ਹ ਕੇ ਕੀਤੀ ਜਾਣੀ ਅਤੇ ਉਹਦੇ ਵਿੱਚ ਝੂਮਰ ਹੋ ਜਾਂਦਾ ਪਟਾਕਾ ਉਹਦੇ ਵਿੱਚ ਭੰਗੜੇ ਦੀ ਹੀ ਫੋਮ ਹੈ ਜੋ ਕਿ ਵਿੱਚ ਉਹਦੇ ਵਿੱਚ ਹਾਂ ਭੰਗੜੇ ਵਿੱਚ ਆਉਂਦੀ ਹੈ ਭੰਗੜੇ ਨਾਲ ਕਿਆ ਹੁੰਦਾ ਭੰਗੜਾ ਇੱਕ ਕਿਆ ਹੈ ਇੱਕ ਹੁਣ ਤਾਂ ਇੱਕ ਕਲਚਰਲ ਫੋਮ ਰਹਿ ਗਿਆ ਪਰ ਇੱਕ ਆਪਣੀ ਖੁਸ਼ੀ ਵਿਅਕਤ ਕਰਨ ਵਾਸਤੇ ਕਿ ਇਹ ਮੋਸਟਲੀ ਕਿਸੇ ਵੀ ਖੁਸ਼ੀ ਦੇ ਮੌਕੇ ਪਰ ਵਿਆਹ ਕਿਸੇ ਦਾ ਜਨਮ ਦਿਨ ਜਿੱਥੇ ਕਿ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਹੋਵੇ ਉੱਥੇ ਭੰਗੜਾ ਆਮ ਤੌਰ 'ਤੇ ਪੰਜਾਬੀਆਂ ਦੁਆਰਾ ਪਾਇਆ ਜਾਂਦਾ ਪਰ ਬਹੁਤ ਜ਼ਿਆਦਾ ਵਧੀਆ ਇਹ ਨਹੀਂ ਹੈ ਕਿ ਸਾਰੇ ਬਹੁਤ ਵਧੀਆ ਭੰਗੜਾ ਪਾਉਂਦੇ ਹਰੇਕ ਆਪਣੀ ਇੰਜੋਇਮੈਂਟ ਦੇ ਚੱਕਰ 'ਚ ਜਿਹੜਾ ਵੀ ਆਰਟ ਫੋਮ ਯੂਜ ਕਰਦਾ ਪੰਜਾਬ ਦੇ ਵਿੱਚ ਮੋਸਟਲੀ ਉਹਨੂੰ ਭੰਗੜਾ ਹੀ ਕਹਿ ਦਿੱਤਾ ਜਾਂਦਾ ਭੰਗੜਾ ਪੰਜਾਬ 'ਚ ਤਾਂ ਪ੍ਰਚਲਿਤ ਹੈਗਾ ਹੀ ਹੈ ਪਰ ਦੁਨੀਆ ਵਿੱਚ ਵੀ ਜਿੱਦਾਂ ਕਿ ਹੁਣ ਸਾਡੇ ਪੰਜਾਬੀ ਕੈਨੇਡਾ ਅਮਰੀਕਾ ਵੱਲ ਗਏ ਹੋਏ ਹੈ ਉੱਥੇ ਵੀ ਹੁਣ ਸੈੱਲੀਬ੍ਰੈਟ ਕੀਤਾ ਜਾਣ ਲੱਗਿਆ ਕਿਉਂਕਿ ਕਿਉਂਕਿ ਉੱਥੇ ਸਾਡੇ ਪੰਜਾਬੀਆਂ ਦੀ ਜਨਸੰਖਿਆ ਵੱਧ ਗਈ ਅਤੇ ਉੱਥੇ ਇੱਕ ਆਹ ਸੈਕੰਡ ਲੈਂਗੂਏਜ਼ ਵੀ ਸਾਡੀ ਪੰਜਾਬੀ ਓ ਹੋ ਗਈ ਇਹ ਹੈ ਕਿ ਪੰਜਾਬੀ ਹੋਣ ਕਰਕੇ ਕਿਆ ਹੋਇਆ ਉੱਥੇ ਦੇ ਇੱਕ ਉੱਥੇ ਦੇ ਵੀ ਕਲਚਰ ਵਿੱਚ ਪੰਜਾਬੀ ਆ ਗਈ ਜਿਵੇਂ ਕਿ ਹੁਣ ਉੱਥੇ ਦੇ ਕੋਲਜਾਂ 'ਚ ਵੀ ਐਨੁਅਲ ਫੰਕਸ਼ਨ ਦੇ ਰੂਪ ਵਿੱਚ ਜਾਂ ਉੱਥੇ ਕੋਈ ਪ ਪ੍ਰੋਗਰਾਮ ਜਾਂ ਵਿਆਹ ਹੁੰਦਾ ਉੱਥੇ ਵੀ ਪੰਜਾਬੀਆਂ ਨੇ ਆਪਣਾ ਭੰਗੜਾ ਪ੍ਰਚਲਿਤ ਕਰਤਾ ਹੁਣ ਲਗਭਗ ਯੂਟਿਊਬ ਸਾਰੀ ਭੰਗੜੇ ਨਾਲ ਹੀ ਭਰੀ ਪਈ ਹੈ ਭੰਗੜਾ ਹੁਣ ਲਾ ਲੋਹੜੀ ਜਾਂ ਨਵੇਂ ਸਾਲ ਦਾ ਫੰਕਸ਼ਨ ਕੀਤੇ ਕੀਤਾ ਜਾਂਦਾ ਪੰਜਾਬ ਦੇ ਸਕੂਲਾਂ ਵਿੱਚ ਮੋਸਟਲੀ ਪੰਜਾ ਭੰਗੜਾ ਹੀ ਪਾਇਆ ਜਾਂਦਾ ਅਤੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਮੌਕਾ ਮਿਲਦਾ